ਹਾਂ ਭੰਗੜਾ ਅਰੇਬਿਕਸ ਸਰੀਰਿਕ ਗਤੀਵਿਧੀਆਂ ਦੇ ਤੌਰ 'ਤੇ ਇੱਕ ਬਹੁਤ ਵਧੀਆ ਕਸਰਤ ਹੈ ਇਹ ਸਰੀਰ ਦੇ ਹਰ ਹਿੱਸੇ ਨੂੰ ਟੋਨ ਕਰਨ ਅਤੇ ਕਸਰਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਜਿਵੇਂ ਕਿ ਕੈਲਰੀਜ ਨੂੰ ਬਰਨ ਕਰਨਾ ਇਸ ਵਿੱਚ ਤੇਜ਼ ਹਲਚਲ ਅਤੇ ਕੁੱਦਾ ਹੁੰਦੀਆਂ ਹਨ ਜੋ ਕੈਲਰੀਜ ਨੂੰ ਬਰਨ ਕਰਨ ਵਿੱਚ ਮਦਦ ਕਰਦੀਆਂ ਹਨ ਜਿਸ ਨਾਲ ਵਜ਼ਨ ਕਢਾਉਣ ਅਤੇ ਲੰਬੇ ਸਮੇਂ ਤੱਕ ਫਿਟ ਰਹਿਣ ਵਿੱਚ ਮਦਦ ਮਿਲਦੀ ਹੈ ਦੂਸਰਾ ਪਹਿਲਾ ਨਾਲੋਂ ਜ਼ਿਆਦਾ ਲਚਕਤਾ ਭੰਗੜਾ ਅਰੇਬਿਕਸ ਵਿੱਚ ਬਹੁਤ ਸਾਰੀਆਂ ਘੁੰਮਣੀਆਂ ਅਤੇ ਸਥਿਤੀਆਂ ਹੁੰਦੀਆਂ ਹਨ ਜੋ ਸਰੀਰ ਦੀ ਲਚਕਤਾ ਨੂੰ ਵਧਾਉਂਦੀਆਂ ਹਨ ਤੀਸਰਾ ਮਨੋਵਿਗਿਆਨਿਕ ਲਾਭ ਇਸ ਤੋਂ ਸਿਰਫ਼ ਸਰੀਰਿਕ ਲਾਭ ਨਹੀਂ ਮਿਲਦੇ ਸਗੋਂ ਇਸ ਨਾਲ ਮਨੋਵਿਗਿਆਨਿਕ ਹਲਚ ਹਾਲਾਤ ਵੀ ਵਧੀਆ ਹੁੰਦੇ ਹੈ ਇਸ ਨਾਲ ਮੂਡ ਉੱਤਮ ਰਹਿੰਦਾ ਹੈ ਅਤੇ ਮਨੁੱਖੀ ਮਨ ਨੂੰ ਤਾਜ਼ਗੀ ਮਿਲਦੀ ਹੈ